ਹੈਲੋ ਕੌਣ ਬੋਲ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਤੁਸੀਂ ਰਾਹੁਲ ਦੀ ਪੀ ਟੀ ਐਮ 'ਤੇ ਕਿਉਂ ਨਹੀਂ ਆਏ ਸੀ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਮੈਂ ਤੁਹਾਡੀ ਮਜਬੂਰੀ ਸਮਝ ਸਕਦੀ ਹਾਂ ਮੈਂ ਮੈਂ ਤੁਹਾਨੂੰ ਹੁਣੇ ਹੀ ਤਾਂ ਰਾਹੁਲ ਦਾ ਪੀ ਪੀ ਟੀ ਐਮ ਦਾ ਰਿਜਲਟ ਦੱਸ ਦਿੰਨੀ ਓਵਰ ਓਵਰਔਲ ਤਾਂ ਰਾਹੁਲ ਨੇ ਬਹੁਤ ਵਧੀਆ ਪਰਫੋਰਮੈਂਸ ਦਿੱਤੀ ਹੈ ਸਾਰੇ ਸਬਜੈਕਟਸ 'ਚ ਸਿਰਫ ਇੱਕ ਇੱਕ ਨੰਬਰ ਘੱਟ ਹੈ ਪਰ ਉਹਦੇ ਇੰਗਲਿਸ਼ 'ਚ ਨੰਬਰ ਬਹੁਤ ਘੱਟ ਨੇ ਮੈਂ ਇਸ ਦਾ ਰੀਜਨ ਜਾਣਨਾ ਚਾਹੁੰਦੀ ਹਾਂ ਕਿ ਉਸ ਦੇ ਇੰਗਲਿਸ਼ ਦੇ ਨੰਬਰ ਕਿਉਂ ਘੱਟ ਆ ਰਹੇ ਨੇ ਅੱਛਾ ਅੱਛਾ ਤਾਂ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਵੀ ਉਸ 'ਤੇ ਫੋਕਸ ਕਰਾਂਗੇ ਅਤੇ ਦੇਖਾਂਗੇ ਉਸਦੇ ਨੰਬਰ ਕਿਉਂ ਘੱਟ ਆ ਰਹੇ ਆ ਜ਼ਿਆਦਾਤਰ ਉਹਦੀ ਗ੍ਰੈਮਰ 'ਤੇ ਮਿਸਟੇਕ ਹੋਣ ਦੀ ਹੈ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਰਾਹੁਲ ਦੀ ਗਰਾਮਰ ਦੇ ਔਰ ਫੋਕਸ ਕਰੋ ਹਾਂਜੀ ਹੋਰ ਕੁਝ ਘਰ ਬਾਰ ਠੀਕ ਹੈ ਨਹੀਂ ਨਹੀਂ ਬਾਕੀ ਸਭ ਕੁਝ ਠੀਕ ਹੈ ਹੋਰ ਵੀ ਸਾਰੇ ਕਿੱਦਾਂ ਸਕੂਲ ਤੋਂ ਪੜ੍ਹਨ ਤੋਂ ਇਲਾਵਾ ਬਾਕੀ ਸਾਰੀ ਕਰੀਕੂਲਮ ਐਕਟੀਵਿਟੀਜ਼ 'ਚ ਵੀ ਹਿੱਸਾ ਲੈਂਦਾ ਬਸ ਇੰਗਲਿਸ਼ ਦੀ ਥੋੜ੍ਹੀ ਜਿਹੀ ਪ੍ਰੋਬਲਮ ਹੈ ਉਹ ਉਹ ਅਸੀਂ ਆਪੇ ਸੁਧਾਰ ਲਵਾਂਗੇ ਹਾਂਜੀ ਓਕੇ ਮੈਡਮ ਓਕੇ